ਬੜਾ ਮਹੱਤਪੂਰਨ ਫੈਸਲਾ ਕਿਉਂਕਿ ਮੈਂ ਪਹਿਲਾਂ ਸਕੂਲ ਦੇ ਵਿੱਚ ਪੜਾਉਂਦਾ ਸੀ ਅਤੇ ਉਹ ਪ੍ਰਾਈਵੇਟ ਜੋਬ ਸੀ ਕਿਉਂਕਿ ਪ੍ਰੋਫੈਸ਼ਨ ਪੱਖੋਂ ਮੇਰੀ ਬੀ ਐੱਡ ਨਹੀਂ ਹੋਈ ਸੀ ਇਸ ਕਰਕੇ ਮੈਨੂੰ ਉਹ ਪ੍ਰੋਫੈਸ਼ਨ ਛੱਡ ਕੇ ਇੱਧਰ ਫੋਟੋਗ੍ਰਾਫੀ ਵੱਲ ਆਉਣਾ ਪਿਆ ਅਤੇ ਮੇਰੇ ਜਿਹੜੇ ਸਾਥੀ ਟੀਚਰ ਸੀ ਉਹਨਾਂ ਦੀ ਸਲਾਹ ਲਈ